ਜੇ ਮੈਂ ਦੁਨੀਆਂ ਵਿੱਚ ਕਿਤੇ ਵੀ ਯਾਤਰਾ ਕਰਨੀ ਹੈ ਤਾਂ ਮੇਰੀ ਦਿਲੀਂ ਖਵਾਹਿਸ਼ ਹੈ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦੀ ਇਹ ਯਾਤਰਾ ਕਰਨ ਦਾ ਮਨਸਾ ਮੇਰੇ ਮਨ ਵਿੱਚ ਕਦੋਂ ਦਾ ਹੈ ਅਤੇ ਮੇਰੀ ਦਿਲ ਤੋਂ ਇੱਛਾ ਹੈ ਕਿ ਮੈਂ ਇਸ ਅਸਥਾਨ ਉੱਪਰ ਜਾਵਾਂ ਜਿੱਥੇ ਦਸਮ ਪਿਤਾ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜਨਮ ਤੋਂ ਪਹਿਲਾਂ ਤਪੱਸਿਆ ਕੀਤੀ ਸੀ ਇਹ ਸਥਾਨ ਸੱਤ ਪਹਾੜੀਆਂ ਵਿੱਚ ਸਥਿਤ ਹੈ ਅਤੇ ਉੱਥੇ ਇੱਕ ਅੰਮ੍ਰਿਤ ਜਲ ਦਾ ਸਰੋਵਰ ਵੀ ਹੈ ਸੁਣਿਆ ਹੈ ਕਿ ਉਸ ਵਿੱਚ ਇਸ਼ਨਾਨ ਕਰਨ ਨਾਲ਼ ਮਨ ਨੂੰ ਸ਼ਾਂਤੀ ਮਿਲਦੀ ਹੈ ਮੈਨੂੰ ਇਹ ਸਥਾਨ ਦੇਖਣ ਦੀ ਬਹੁਤ ਇੱਛਾ ਹੈ ਅਤੇ ਮੈਂ ਇੱਥੇ ਜਾਣਾ ਚਾਹੁੰਦੀ ਹਾਂ